ਮੈਂ ਯੂਟੀਊਬ 'ਤੇ ਕਿਸੇ ਦੇ ਪਾਇਆ ਦੇਖ ਕੇ ਮੈਨੂੰ ਸ਼ੌਂਕ ਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਡਿਜ਼ਾਇਨ ਬਣਾਵਾਂ ਮੇਰੇ ਲਈ ਇਹ ਚੁਣੌਤੀ ਪੂਰਵ ਪੂਰਨ ਕੰਮ ਹੁੰਦਾ ਹੈ ਇਸੇ ਤਰ੍ਹਾਂ ਮੈਂ ਇੱਕ ਸੂਟ ਦਾ ਡਿਜ਼ਾਇਨ ਦੇਖਿਆ ਜੋ ਮੈਂ ਆਪਣੀ ਬੇਟੀ ਲਈ ਤਿਆਰ ਕਰਨਾ ਚਾਹੁੰਦੀ ਸੀ ਫਿਰ ਮੈਂ ਉਸ ਨੂੰ ਸਿੱਖਿਆ ਅਤੇ ਮੈਂ ਉਸ ਉਹਨੂੰ ਬਣਾ ਕੇ ਤਿਆਰ ਕੀਤਾ ਉਹਨੂੰ ਡਿਜ਼ਾਇਨ ਤਿਆਰ ਕਰਕੇ ਦੇਖ ਕੇ ਮੇਰੀ ਬੇਟੀ ਦੀਆਂ ਸਹੇਲੀਆਂ ਵੀ ਕਹਿਣ ਲੱਗੀਆਂ ਆਂਟੀ ਸਾਨੂੰ ਵੀ ਇਹੀ ਡਿਜ਼ਾਇਨ ਬਣਾ ਕੇ ਦਿਓ ਫਿਰ ਉਹਨਾਂ ਨੂੰ ਵੀ ਬਣਾ ਕੇ ਦਿੱਤਾ ਫਿਰ ਇਹਦੇ ਨਾਲ ਮੈਨੂੰ ਬਹੁਤ ਇਨਕਮ ਵੀ ਹੋਈ ਅਤੇ ਹੁਣ ਮੈਂ ਇੱਕ ਛੋਟਾ ਜਿਹਾ ਬੁਟੀਕ ਵੀ ਚਲਾਉਂਦੀ ਹਾਂ ਇਸ ਦੇ ਨਾਲ ਮੇਰੇ ਹੋਰ ਕਸਟਮਰ ਵੀ ਆਉਂਦੇ ਹਨ ਉਹ ਵੀ ਕਹਿੰਦੇ ਹਨ ਮੈਨੂੰ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਬਣਾ ਕੇ ਤਿਆਰ ਕਰਕੇ ਦੋ ਇਸੇ ਤਰ੍ਹਾਂ ਮੇਰਾ ਬੁਟੀਕ ਬਹੁਤ ਵਧੀਆ ਚੱਲਣ ਲੱਗ ਗਿਆ ਹੈ ਹੁਣ ਮੈਨੂੰ ਬਹੁਤ ਜ਼ਿਆਦਾ ਇਨਕਮ ਹੋਣ ਲੱਗ ਗਈ ਹੈ ਔਰ ਮੇਰਾ ਬੁਟੀਕ ਦਾ ਨਾਮ ਵੀ ਚੱਲ ਪਿਆ ਹੈ